ਮੈਂ ਆਪਣੇ ਘਰ ਦੀ ਨਵੀਂ ਰਿਪੇਅਰ ਕਰਵਾਈ ਅਤੇ ਮੇਰੇ ਪੁਰਾਣੇ ਘਰ ਦੇ ਮੁਤਾਬਿਕ ਉਸ ਦੇ ਵਿੱਚ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਮੈਂ ਆਪਣੇ ਨਵੇਂ ਘਰ ਦੇ ਵਿੱਚ ਪਾਣੀ ਦੀ ਟੂਟੀਆਂ ਫਾਈਵ ਸਟਾਰ ਥਰੀ ਸਟਾਰ ਲਗਵਾਈਆਂ ਤਾਂ ਕਿ ਪਾਣੀ ਦੀ ਵਰਤੋਂ ਘੱਟ ਹੋ ਸਕੇ ਹੋ ਸੇ ਜਿੰਨੀ ਕੁ ਹੋ ਸਕੇ ਪਾਣੀ ਦਾ ਬਚਾਅ ਹੋ ਸਕੇ ਪਾਈਪਾਂ ਟੂਟੀਆਂ ਇਸ ਕਰਕੇ ਮੈਂ ਉਸ ਹਿਸਾਬ ਨਾਲ ਲਗਵਾਈਆਂ ਕਿ ਜਿੰਨਾਂ ਹੋ ਸਕੇ ਪਾਣੀ ਦੀ ਸੰਭਾਲ ਕੀਤੀ ਜਾਵੇ